ਜੋ ਵਿਅਕਤੀ ਗਾਉਣਾ ਸ਼ੁਰੂ ਕਰਨਾ ਚਾਹੁੰਦਾ ਹੈ ਉਸ ਲਈ ਬਹੁਤ ਸਾਰੇ ਵਿਕਲਪ ਹਨ ਮੈਂ ਤਾਂ ਉਸਨੂੰ ਇਹੀ ਸਲਾਹ ਦੇਵਾਂਗਾ ਕਿ ਪਹਿਲਾਂ ਤਾਂ ਉਹ ਇੱਕ ਗੁਰੂ ਧਾਰਨ ਕਰੇ ਜਿਸ ਨੂੰ ਸੰਗੀਤ ਸਿੱਖਿਆ ਬਾਰੇ ਬਹੁਤ ਸਾਰਾ ਗਿਆਨ ਹੋਵੇ ਅਤੇ ਸੁਰਾਂ ਦਾ ਮਾਹਿਰ ਹੋਵੇ ਉਹ ਗੁਰੂ ਧਾਰਨ ਕਰਨ ਤੋਂ ਬਾਅਦ ਫਿਰ ਉਸਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੇ ਜਿਵੇਂ ਉਹ ਕਹੇ ਉੱਦਾਂ ਉਹ ਕਰੇ ਫੇਰ ਉਹਨੂੰ ਮੈਂ ਇਹ ਵੀ ਕਹਾਂਗਾ ਕਿ ਉਹ ਇੱਕ ਆਪਣਾ ਆਪਦਾ ਜੋ ਜਿਸ ਵਿੱਚ ਉਹ ਮਾਹਿਰ ਹੋਣਾ ਚਾਹੁੰਦਾ ਹੈ ਉਹ ਇੰਸਟਰੂਮੈਂਟ ਲਿਆ ਕੇ ਰੱਖੇ ਜਿਵੇਂ ਸਾਰੰਗੀ ਲਿਆ ਕੇ ਰੱਖ ਸਕਦਾ ਹੈ ਤਬਲਾ ਲਿਆ ਕੇ ਰੱਖ ਸਕਦਾ ਹੈ ਅਤੇ ਹਰਮੋਨੀਅਮ ਜੋ ਕਿ ਇੱਕ ਬੜੀ ਹੀ ਮੁੱਢਲੀ ਲੋੜ ਹੈ ਕਿਸੇ ਨੂੰ ਸੰਗੀਤਕ ਬਣਨ ਵਾਸਤੇ ਸੰਗੀਤਕਾਰ ਬਣਨ ਵਾਸਤੇ ਅਤੇ ਰੋਜ਼ ਉਹ ਜਿਹੜੇ ਸੱਤ ਸੁਰ ਹੁੰਦੇ ਹੁੰਦੇ ਹਨ ਉਹਨਾਂ ਦਾ ਰਿਆਜ਼ ਕਰੇ ਠੀਕ ਹੈ ਸਕੇਲ ਨੂੰ ਉੱਚਾ ਲੈ ਕੇ ਜਾਣਾ ਕਿੱਦਾਂ ਸਕੇਲ ਨੂੰ ਨੀਚੇ ਲੈ ਕੇ ਆਉਣਾ ਇਸ ਦਾ ਜਿਸ ਜਿੰਨਾ ਵੱਧ ਤੋਂ ਵੱਧ ਉਹ ਪ੍ਰੈਕਟਿਸ ਕਰ ਸਕੇਗਾ ਉਹੀ ਉਹ ਚੀਜ਼ ਉਸਨੂੰ ਪਰਫੈਕਟ ਬਣਾਏਗੀ ਅੱਗੇ ਜਾ ਕੇ ਜੋ ਕਿ ਬਹੁਤ ਜ਼ਰੂਰੀ ਹੈ ਸੰਗੀਤਕਾਰ ਵਾਸਤੇ ਜਿਵੇਂ ਕਿ ਅੱਜ ਦੇ ਯੁੱਗ ਦੇ ਵਿੱਚ ਸਾਡੇ ਵਰਗੇ ਨੌਜਵਾਨ ਨੂੰ ਇਹੀ ਹੁੰਦਾ ਕਿ ਮੈਂ ਇੱਕ ਵੱਡਾ ਸਟਾਰ ਬਣਨਾ ਮੈਂ ਇੱਕ ਸੰਗੀਤਕਾਰ ਬਣਨਾ ਇੱਕ ਕੋਂਪੀਟੀਸ਼ਨ ਹੋ ਗਿਆ ਅੱਜ ਕੱਲ੍ਹ ਬਹੁਤ ਵੱਧ ਗਿਆ ਅਤੇ ਇਸ ਵਿੱਚ ਜੇ ਆਪਾਂ ਬਿਹਤਰ ਬਣਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਵੱਧ ਤੋਂ ਵੱਧ ਪ੍ਰੈਕਟਿਸ ਕਰਨ ਕਰਕੇ ਹੀ ਆਪਾਂ ਮਾਹਿਰ ਬਣ ਸਕਾਂਗੇ ਮੇਰੀ ਸਭ ਤੋਂ ਵੱਡੀ ਰਾਏ ਤੁਹਾਨੂੰ ਇਹੀ ਹੋਏਗੀ ਕਿ ਇਸ ਚੀਜ਼ ਨੂੰ ਦਿਲ ਨਾਲ ਕਰੇ ਜੋ ਵੀ ਉਹ ਕਰਨਾ ਚਾਹ ਰਿਹਾ ਉਹਨੂੰ ਦਿਲ ਨਾਲ ਕਰੇ ਤਾਂ ਬਹੁਤ ਅੱਛਾ ਹੋਵੇਗਾ